ਹੈਲੋ ਗੌਰਵ ਬਸ ਸਰਵਿਸ ਤੋਂ ਬੋਲ ਰਹੇ ਹੋ ਮੈਡਮ ਤੁਸੀਂ ਮਤਲਬ ਮੈਂ ਪਿੱਛੇ ਤੁਹਾਡੀ ਬਸ 'ਚ ਟਰੈਵਲ ਕਰ ਰਹੀ ਹਾਂ ਇਸ ਟੇਮ ਅਤੇ ਤੁਸੀਂ ਥਰੜ੍ਹਾ ਮੇਰੀ ਮਤਲਬ ਸੀਟ ਚੇਂਜ ਕਰਨ ਦੀ ਕੋਸ਼ਿਸ਼ ਕਰ ਦਿਓ ਕਿਉਂਕਿ ਆ ਮੈਂ ਸਾਰਿਆਂ ਤੋਂ ਲਾਸਟ ਹਾਂ ਇੱਥੇ ਬਹੁਤ ਹੀ ਜ਼ਿਆਦਾ ਦਿੱਕਤ ਹੋ ਰਹੀ ਹੈ ਥੋੜ੍ਹੀ ਸਫਾਈ ਵੀ ਨਹੀਂ ਹੈਗੀ ਅਤੇ ਜੈਂਟਸ ਹੈਗੇ ਆ ਮੈਂ ਲੇਡੀਜ ਇਕੱਲੀ ਹਾਂ ਵਿੱਚ ਅਤੇ ਮੈਮ ਮੈਂ ਪੱਚੀ ਨੰਬਰ ਸੀਟ 'ਤੇ ਹਾਂ ਅਤੇ ਤੁਸੀਂ ਅ ਮੈਡਮ ਇੱਥੇ ਤਾਂ ਮਤਲਬ ਸਾਰੇ ਬੰਦੇ ਬੰਦੇ ਹੀ ਆ ਮੈਂ ਕੱਲੀ ਲੇਡੀਸ ਹਾਂ ਵਿੱਚ ਅਤੇ ਇੱਕ ਇੱਥੇ ਮਤਲਬ ਥੋੜ੍ਹਾ ਬਹੁਤ ਹੀ ਜ਼ਿਆਦਾ ਟਾਈਟ ਹੋ ਰਿਹਾ ਇੱਕ ਇੱਥੇ ਥੋੜ੍ਹਾ ਜਿਹਾ ਗੰਦਗੀ ਵੀ ਹੈ ਮੈਨੂੰ ਸਫੋਕੇਸ਼ਨ ਜਿਹੀ ਹੋ ਗਈ ਹੈ ਸਾਹ ਲੈਣ 'ਚ ਥੋੜ੍ਹੀ ਦਿੱਕਤ ਹੋ ਰਹੀ ਹੈ ਵਿੰਡ ਇਹ ਵਾਲੀ ਲਾਸਟ ਵਾਲੀ ਜਿਹੜੀ ਹੈ ਬਾਰੀ ਵੀ ਨਹੀਂ ਖੁੱਲ੍ਹ ਰਹੀ ਇੱਧਰੋਂ ਹਵਾ ਦੀ ਕਰੋਸਿੰਗ ਨਹੀਂ ਹੋ ਰਹੀ ਅਤੇ ਓਕੇ ਮੈਮ ਤੁਸੀਂ ਮਤਲਬ ਜਲਦੀ ਕਰ ਦਿਓ ਮੈਨੂੰ ਨਾ ਬਸ 'ਚ ਟਰੈਵਲ ਕਰਨ 'ਚ ਥੋੜ੍ਹੀ ਪ੍ਰੋਬਲਮ ਹੋ ਰਹੀ ਹੈ ਹਾਂਜੀ ਹਾਂਜੀ ਮੈਡਮ ਤੁਸੀਂ ਥੋੜ੍ਹਾ ਸਮਝੋ ਨਾ ਮੇਰੇ ਮਤਲਬ ਲੇਗਸ 'ਚ ਵੀ ਪ੍ਰੋਬਲਮ ਹੈ ਅਤੇ ਮੈਂ ਆਪਣੀਆਂ ਲੱਤਾਂ ਵੀ ਵਧੀਆ ਤਰ੍ਹਾਂ ਸਿੱਧੀਆਂ ਨਹੀਂ ਕਰ ਪਾ ਰਹੀ ਹਾਂ ਤੁਸੀਂ ਐਵੇਂ ਦੀ ਸੀਟ ਟਰਾਈ ਕਰੋ ਜਿੱਥੇ ਥੋੜ੍ਹਾ ਜਿਹਾ ਮੈਂ ਕੰਫਰਟੇਬਲ ਫੀਲ ਕਰਾਂ ਮੇਰੀਆਂ ਲੇਗਸ 'ਚ ਮਤਲਬ ਕੋਈ ਪ੍ਰੋਬਲਮ ਨਾ ਆਵੇ ਅਸੀਂ ਵਾਇਆ ਜਲੰਧਰ ਤੱਕ ਜਾਣਾ ਹਾਂਜੀ ਓਕੇ ਤੁਸੀਂ ਫਿਰ ਮੈਡਮ ਥੋੜ੍ਹਾ ਅੱਗੇ ਤੋਂ ਵੀ ਸਫਾਈ ਦਾ ਧਿਆਨ ਖ਼ਾਸ ਰੱਖਿਆ ਕਰੋ ਇਸ 'ਚ ਸਫਾਈ ਵੀ ਨਹੀਂ ਹੈਗੀ ਬਹੁਤ ਜ਼ਿਆਦਾ ਗੰਦੀ ਸਮੈਲ ਵੀ ਆ ਰਹੀ ਹੈ ਲਾਸਟ 'ਤੇ ਤੁਸੀਂ ਜਿਨ੍ਹਾਂ ਕੋਲੋਂ ਬਸ ਸਫਾਈ ਕਰਵਾਉਂਦੇ ਹੋ ਥੋੜ੍ਹਾ ਕਹੋ ਮਤਲਬ ਲਾਸਟ ਤੱਕ ਚੰਗੀ ਤਰ੍ਹਾਂ ਸਾਫ਼ ਕਰਨ ਹਾਂਜੀ ਕੋਈ ਗੱਲ ਨਹੀਂ ਮੈਮ ਤੁਸੀਂ ਥੋੜ੍ਹਾ ਬਸ 'ਤੇ ਲਿਖ ਦੋ ਨਾ ਬੰਦਾ ਥੋੜ੍ਹੇ ਪੜ੍ਹ ਕੇ ਬੰਦੇ ਨੇ ਦਿਮਾਗ 'ਚ ਜਲਦੀ ਪੈ ਜਾਂਦਾ ਥੋੜ੍ਹਾ ਲਾਇੰਸ ਵੀ ਖੁਦ ਸਫਾਈ ਦਾ ਧਿਆਨ ਰੱਖਣ ਅਤੇ ਥੋੜ੍ਹਾ ਸਮਾਨ ਰੱਖਣ ਦੀ ਵੀ ਮਤਲਬ ਪ੍ਰੋਬਲਮ ਹੈ ਇੱਥੇ ਸਾਰਿਆਂ ਨੇ ਸਮਾਨ ਆਪਣੇ ਅੱਗੇ ਹੀ ਲਿਆ ਹੈ ਹੋਇਆ ਤੁਸੀਂ ਥੋੜ੍ਹਾ ਜਿਹਾ ਉੱਪਰ ਰਖਵਾਇਆ ਕਰੋ ਜਾਂ ਆਪਣੇ ਨੀਚੇ ਬਸ ਦੇ ਡਿੱਗੀ 'ਚ ਰਖਵਾਇਆ ਕਰੋ ਹਾਂ ਜੀ ਮੈਮ ਬਸ ਮੈਮ ਤੁਸੀਂ ਬਸ ਸੀਟ ਨੰਬਰ ਮੈਨੂੰ ਦੱਸ ਦਿਓ ਥੋੜ੍ਹੀ ਦੇਰ ਬਾਅਦ ਜਦੋਂ ਵੀ ਕੋਈ ਸਟੇਸ਼ਨ ਆਉਂਦਾ ਹੈ ਤਾਂ ਓਕੇ ਮੈਮ ਥੈਂਕ ਯੂ